ਸਾਡੇ ਖੇਤਰ ਦੇ ਜਿਹੜੇ ਸਟੇਡੀਅਮ ਨੇ ਗਰਾਉਂਡਾਂ ਦੇ ਖੇਡ ਸਮਾਗਮ ਕਰਵਾਉਣ ਲਈ ਹੈ ਨਾ ਬਹੁਤ ਜ਼ਿਆਦਾ ਸਹੂਲਤਾਂ ਨੇ ਜਿਹੜੀਆਂ ਉਪਲਬਧ ਕਰਵਾਈਆਂ ਗਈਆਂ ਨੇ ਜਿਵੇਂ ਸਾਡੀ ਅੱਜ ਕੱਲ੍ਹ ਦੀ ਭਗਵੰਤ ਮਾਨ ਦੀ ਸਰਕਾਰ ਹੈ ਨਾ ਉਹਨਾਂ ਨੇ ਬਹੁਤ ਜ਼ਿਆਦਾ ਬੱਚਿਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਜਿਹੜੇ ਕਿ ਹਰ ਇੱਕ ਏਜ਼ ਦੇ ਲਈ ਹਰ ਇੱਕ ਉਮਰ ਦੇ ਲਈ ਚਾਹੇ ਉਹ ਵੱਡੇ ਨੇ ਚਾਹੇ ਬੱਚੇ ਨੇ ਚਾਹੇ ਉਹ ਨੌਜਵਾਨ ਨੇ ਹਰ ਇੱਕ ਉਮਰ ਲਈ ਉਹ ਪ ਬੱਚੇ ਇਹਨਾਂ 'ਚ ਪਾਰਟੀਸਪੇਟ ਕਰਦੇ ਨੇ ਅਤੇ ਇਹ ਨੇ ਜਿਹੜੇ ਬੱਚੇ ਇੱਦਾਂ ਜਾਂ ਸਿਆਣੇ ਆਪਣੇ ਆਪ ਨੂੰ ਪਾਰਟੀਸਪੇਟ ਕਰਕੇ ਆਪਣੇ ਤਨ ਮਨ ਦੀ ਜਿਹੜੀ ਸੰਤੁਸ਼ਟੀ ਆ ਤੰ ਜਾਂ ਤੰਦਰੁਸਤੀ ਆ ਉਹਨੂੰ ਕਾਇਮ ਰੱਖਦੇ ਨੇ ਅਤੇ ਐਵੀਂ ਮਤਲਬ ਜਿਵੇਂ ਅਰੀਨਾਸ ਬਹੁਤ ਜ਼ਿਆਦਾ ਬਣੇ ਹੋਏ ਨੇ ਹੈ ਨਾ ਅਤੇ ਮਤਲਬ ਇਹ ਵੀ ਅਸੀਂ ਕਹਿ ਸਕਦੇ ਹਾਂ ਖੇਡ ਸਮਾਗਮ ਕਰਵਾਉਣ ਲਈ ਜਿਹੜੇ ਨੇੜੇ ਨੇੜੇ ਜਿਵੇਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਕਿੰਨੇ ਸਕੂਲ ਨੇ ਕਿੰਨੇ ਕੋਲਿਜ ਨੇ ਜਿਨ੍ਹਾਂ ਦੇ ਵਿੱਚ ਅਲੱਗ ਅਲੱਗ ਸੈਂਟਰ ਪ੍ਰੋਵਾਈਡ ਕੀਤੇ ਜਾਂਦੇ ਤਾਂ ਜੋ ਖੇਡ ਸਮਾਗਮਾਂ ਵਾਲੀ ਜਗ੍ਹਾ 'ਤੇ ਜ਼ਿਆਦਾ ਭੀੜ ਭੜੱਕਾ ਨਾ ਹੋਵੇ ਅਲੱਗ ਅਲੱਗ ਜਗ੍ਹਾਂ 'ਤੇ ਟੂਰਨਾਮੈਂਟ ਕੰਡਕਟ ਕਰਵਾਉਣ ਕਰਕੇ ਰੱਸ਼ ਵੀ ਐਨਾ ਨਹੀਂ ਹੁੰਦਾ ਅਤੇ ਇਸ ਕਰਕੇ ਸਾਨੂੰ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਬਹੁਤ ਵਧੀਆ ਲੱਗਦੀਆਂ ਨੇ